ਜੇ ਤੁਸੀਂ ਆਨਲਾਈਨ ਦੋ ਚੀਜ਼ਾਂ ਸੇਮ ਮੰਗਵਾ ਲੈਂਦੇ ਹੋ ਇੱਕ ਚੀਜ਼ ਨੂੰ ਰੱਦ ਕਰਨ ਲਈ ਕਿਸੇ ਵੀ ਐਪ ਦੇ ਆਪਸ਼ਨ ਵਿੱਚ ਜਾ ਕੇ ਉਹਦੀ ਰਿਟਨ ਪੋਲਿਸੀ ਦੇ ਵਿੱਚ ਜਾ ਕੇ ਅਸੀਂ ਉਸ ਨੂੰ ਬੜੀ ਆਸਾਨੀ ਦੇ ਨਾਲ ਵਾਪਿਸ ਕੀਤਾ ਜਾ ਸਕਦਾ ਹੈ